ਮੈਂ ਆਪਣੇ ਘਰ ਦੇ ਆਲੇ ਦੁਆਲੇ ਇਲਾਕਿਆਂ ਨੂੰ ਸਾਫ ਰੱਖਣ ਲਈ ਬਹੁਤ ਸਾਰੇ ਉਪਾਅ ਕਰਦਾ ਹਾਂ ਜਿਵੇਂ ਕਿ ਆਪਾਂ ਕਹਿੰਦੇ ਹਾਂ ਵੀ ਕੁਝ ਵੀ ਚੰਗਾ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਹੈ ਕੁਝ ਵੀ ਚੰਗਾ ਕਰਨ ਲਈ ਆਪਾਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਦੇ ਵਿੱਚ ਹੀ ਆਪਣੀ ਪੂਰੀ ਸਾਫ ਸਫਾਈ ਰੱਖਦਾ ਹਾਂ ਰੋਜ਼ ਝਾੜੂ ਦਿੰਦਾ ਹਾਂ ਪੋਚੇ ਲਾਉਂਦਾ ਹਾਂ ਅਤੇ ਕਦੇ ਵੀ ਮੈਂ ਕੁਝ ਵੀ ਖਾਵਾਂ ਤਾਂ ਉਸ ਨੂੰ ਇੱਕ ਡਸਟਬੀਨ ਦੇ ਵਿੱਚ ਜ਼ਰੂਰ ਪਾਉਂਦਾ ਹਾਂ ਅਤੇ ਜਾਂ ਮੈਂ ਜਿਵੇਂ ਕਿਤੇ ਬਾਹਰ ਜਾਣਾ ਹੋਵੇ ਤਾਂ ਮੈਂ ਉੱਥੇ ਕੁਛ ਖਾਵਾਂ ਜੇ ਆਸੇ ਪਾਸੇ ਮੈਨੂੰ ਡਸਟਬੀਨ ਆਪਣੇ ਆਲੇ ਦੁਆਲੇ ਡਸਟਬੀਨ ਕੋਈ ਦਿਖਦਾ ਹੈ ਤਾਂ ਮੈਂ ਉਹ ਆਪਣੀ ਜਿਹੜੀ ਚੀਜ਼ ਹੈ ਉਹ ਡਸਟਬੀਨ 'ਚ ਪਾਉਦਾ ਹਾਂ ਅਤੇ ਜੇ ਮੈਨੂੰ ਕੋਈ ਵੀ ਡਸਟਬਿਨ ਨਹੀਂ ਦਿਖਦਾ ਤਾਂ ਮੈਂ ਆਪਣੇ ਨਾਲ ਇੱਕ ਲਿਫਾਫਾ ਜ਼ਰੂਰ ਰੱਖਦਾ ਹਾਂ ਤਾਂ ਜੋ ਮੈਂ ਜੋ ਖਰਾਬ ਜਾਂ ਕੋਈ ਸੁੱਟਣ ਵਾਲੀ ਚੀਜ਼ ਹੈ ਤਾਂ ਉਸ ਨੂੰ ਮੈਂ ਲਿਫਾਫੇ ਵਿੱਚ ਪਾਈ ਜਾਂਦਾ ਹਾਂ ਅਤੇ ਘਰ ਆ ਕੇ ਮੈਂ ਉਸ ਨੂੰ ਡਸਟਬੀਨ ਦੇ ਵਿੱਚ ਪਾਉਂਦਾ ਹਾਂ ਇਹ ਸਾਫ ਸਫਾਈ ਰੱਖਣ ਨਾਲ ਸਭ ਤੋਂ ਵੈਸੇ ਤਾਂ ਸਾਫ ਸਫਾਈ ਰੱਖਣਾ ਆਪਣੇ ਸਭ ਦੀ ਜ਼ਿੰਮੇਵਾਰੀ ਹੈ ਅਤੇ ਸਾਫ ਸਫਾਈ ਰੱਖਣ ਨਾਲ ਆਪਣਾ ਸਭ ਤੋਂ ਜ਼ਿਆਦਾ ਖਰਚਾ ਬਚਦਾ ਹੈ ਜਿਵੇਂ ਕਿ ਜੇ ਆਪਾਂ ਸਾਫ ਸਫਾਈ ਨਾ ਰੱਖਾਂਗੇ ਤਾਂ ਉਸ ਦੇ ਵਿੱਚ ਤਾਂ ਕੀਟਾਣੂ ਪੈਦਾ ਹੋ ਜਾਣਗੇ ਅਤੇ ਕੀਟਾਣੂ ਬਾਅਦ ਦੇ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰਨਗੇ ਅਤੇ ਆਪਣੀ ਸਿਹਤ ਖਰਾਬ ਹੋਊਗੀ ਅਤੇ ਆਪਣੇ ਜਿਹੜੇ ਵੀ ਆਪਾਂ ਮਿਹਨਤ ਨਾਲ ਕਮਾਏ ਪੈਸੇ ਹਨ ਉਹ ਸਾਰੇ ਦਵਾਈਆਂ ਵਿੱਚ ਹੀ ਉੱਡ ਜਾਣਗੇ ਅਤੇ ਇਸ ਕਰਕੇ ਆਪਾਂ ਨੂੰ ਸਾਫ ਸਫਾਈ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਆਪਣੀ ਸਾਫ ਸਫਾਈ ਨਾਲ ਹੀ ਆਪਾਂ ਆਪਣੇ ਦੇਸ਼ ਦਾ ਸੁਧਾਰ ਕਰ ਸਕਦੇ ਹਾਂ ਧੰਨਵਾਦ ਜੀ